ਹੈਲੋ ਹੈਲੋ ਮੈਮ ਮੈਂ ਹਰਜਿੰਦਰ ਕੌਰ ਬੋਲਦੀ ਹਾਂ ਹਾਂਜੀ ਤੁਸੀਂ ਬੋਲਦੇ ਹੋ ਨਾ ਟੇਲਰ ਹਾਂਜੀ ਮੈਂ ਸੂਟ ਬਣਵਾਉਣਾ ਸੀਗਾ ਜੀ ਮੈਂ ਤੁਹਾਨੂੰ ਆਪਣਾ ਪੁਰਾਣਾ ਨਾਪ ਲਿਖਾ ਰਹੀ ਹਾਂ ਹਾਂਜੀ ਹਾਂਜੀ ਗਲਾ ਰੱਖ ਦਿਓ ਤੁਸੀਂ ਦੋ ਇੰਚ ਰੱਖ ਦਿਓ ਤੀਰਾ ਰੱਖ ਦਿਓ ਜੀ ਆਪਣੇ ਹਿਸਾਬ ਨਾਲ ਰੱਖ ਦਿਓ ਹਾਂਜੀ ਅਤੇ ਲੰਬਾਈ ਇਹਦੇ 'ਚ ਰੱਖ ਦਿਓ ਬਿਆਲੀ ਹਾਂਜੀ ਫੀਟਿੰਗ ਬਾਈ ਰੱਖ ਦਿਓ ਨਹੀਂ ਨੈਰੋ ਸਲਵਾਰ ਬਣਾ ਦਿਓ ਲੰਬਾਈ ਰੱਖ ਦਿਓ ਤੁਸੀਂ ਆਪਣੇ ਹਿਸਾਬ ਨਾਲ ਰੱਖ ਦਿਓ ਪੁਰਾਣੇ ਨਾਪ ਦੇ ਹਿਸਾਬ ਨਾਲ ਰੱਖ ਦਿਓ ਮੌਰੀ ਤੰਗ ਮੌਰੀ ਕਰ ਦਿਓ ਅਤੇ ਚੌੜੀ ਮੌਰੀ ਕਰ ਦਿਓ ਜੀ ਹਾਂਜੀ ਲੰਬਾਈ ਤੁਸੀਂ ਰੱਖ ਦਿਓ ਆਪਣੇ ਹਿਸਾਬ ਨਾਲ ਪੌਣੀ ਕੁ ਰੱਖ ਦਿਓ

ਨਹੀਂ ਲਾ ਦਿਓ ਉਹ ਤੁਸੀਂ ਪੁਰਾਣੇ ਹਿਸਾਬ ਦੇ ਨਾਲ ਰੱਖ ਦਿਓ ਜਿਹੜਾ ਪੁਰਾਣਾ ਨਾਪ ਦਿੱਤਾ ਤੁਹਾਨੂੰ ਹਾਂ ਹਾਂਜੀ ਹਾਂਜੀ ਲਾਣੀ ਹੈ ਜੀ ਹਾਂਜੀ ਲਾ ਦਿਓ ਜੀ ਨਹੀਂ ਬਿਨਾਂ ਲਾਈਨਿੰਗ ਤੋਂ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ